ਸਿੱਖ ਮੈਂ ਸਿੱਖ ਧਰਮ ਨਾਲ ਸਬੰਧ ਰੱਖਦੀ ਹਾਂ ਅਤੇ ਸਿੱਖ ਧਰਮ ਨਾਲ ਬਹੁਤ ਸਾਰੇ ਮਹੱਤਵਪੂਰਨ ਇਤਿਹਾਸਿਕ ਘਟਨਾਵਾਂ ਜੁੜੀਆਂ ਹੋਈਆਂ ਹਨ ਸਿੱਖ ਧਰਮ ਦਾ ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਹਨ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਧਰਤੀ 'ਤੇ ਆਉਣ ਤੋਂ ਬਾਅਦ ਸਭ ਕੁਝ ਸਹੀ ਹੋਣ ਲੱਗ ਪਿਆ ਅਤੇ ਹੌਲੀ ਹੌਲੀ ਬਹੁਤ ਸਾਰੇ ਗੁਰੂ ਅਜਿਹੇ ਆਏ ਜਿਨਾਂ ਨੇ ਸਿੱਖ ਧਰਮ ਬਚਾਉਣ ਲਈ ਬਹੁਤ ਸਾਰੀਆਂ ਲੜਾਈਆਂ ਲੜੀਆਂ ਅਤੇ ਜਿੱਤੇ ਵੀ ਸਿੱਖ ਧਰਮ ਹੀ ਸਿਰਫ ਇੱਕ ਅਜਿਹਾ ਧਰਮ ਹੈ ਜਿਸ ਵਿੱਚ ਬਹੁਤ ਸਾਰੀਆਂ ਸ਼ਹੀਦੀਆਂ ਹੋਈਆਂ ਹਨ ਤਾਂ ਕਿ ਅਗਰ ਲੋਕਾਂ ਨੂੰ ਇਹ ਸੇਧ ਦਿੱਤੀ ਗਈ ਹੈ ਕਿ ਚਾਹੇ ਕੁਝ ਵੀ ਹੋ ਜਾਵੇ ਪਰ ਆਪਣੇ ਹੱਕ ਲਈ ਜ਼ਰੂਰ ਲੜੋ ਅਤੇ ਇੱਕ ਦਿਨ ਇੱਕ ਨਾ ਇੱਕ ਦਿਨ ਤੁਹਾਨੂੰ ਆਪਣਾ ਹੱਕ ਜਰੂਰ ਮਿਲੇਗਾ ਅਤੇ ਇਸ ਇਹਨਾਂ ਸੰਘਰਸ਼ਾਂ ਦੇ ਕਾਰਨ ਹੀ ਅੱਜ ਅਸੀਂ ਖੁੱਲੇ ਘੁੰਮ ਰਹੇ ਹਾਂ ਅਤੇ ਆਜ਼ਾਦੀ ਮਹਿਸੂਸ ਕਰ ਰਹੇ ਹਾਂ